ਸਕਰੀਨ ਟਾਈਮ ਵਧਣ ਦੇ ਨਾਲ ਰਿਸ਼ਤਿਆਂ ਵਿੱਚ ਵੀ ਫਿੱਕ ਪਈ ਹੈ ਇਹ ਗੱਲ ਨਾਲ ਮੈਂ ਬੜੀ ਚੰਗੀ ਤਰ੍ਹਾਂ ਸਹਿਮਤ ਹਾਂ ਕਿਉਂਕਿ ਪਹਿਲਾਂ ਜ਼ਮਾਨੇ ਵਿੱਚ ਸਾਰੇ ਰਿਸ਼ਤੇਦਾਰ ਭਰਾ ਭੈਣ ਚਾਚੇ ਚਾਚੀਆਂ ਇਕੱਠੇ ਬਹਿ ਕੇ ਗੱਲਾਂ ਬਾਤਾਂ ਘੰਟਾ ਘੰਟਾ ਤੱਕ ਕਰਦੇ ਰਹਿੰਦੇ ਸੀ ਉਹਨਾਂ ਨੂੰ ਕੋਈ ਵੀ ਚਿੰਤਾ ਨਹੀਂ ਹੁੰਦੀ ਸੀ ਪਰ ਅੱਜ ਦੇ ਜ਼ਮਾਨੇ ਵਿੱਚ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਮੋਬਾਈਲਾਂ ਵਿੱਚ ਵੜੇ ਹਨ ਉਹਨਾਂ ਦਾ ਦਿਮਾਗ ਅਤੇ ਉਹਨਾਂ ਦੇ ਸਰੀਰ 'ਤੇ ਬਹੁਤ ਵੱਡਾ ਅਸਰ ਪੈਂਦਾ ਹੈ ਪਹਿਲੇ ਜ਼ਮਾਨੇ ਵਿੱਚ ਲੋਕ ਚੁਸਤ ਰਹਿੰਦੇ ਸਨ ਉਹ ਭੱਜ ਦੌੜ ਨਸ ਭੱਜ ਕਰਦੇ ਸਨ ਖੁਸ਼ ਰਹਿੰਦੇ ਸੀ ਸਾਰਿਆਂ ਨਾਲ ਹੱਸ ਖੇਡ ਕੇ ਗੱਲਾਂ ਕਰਦੇ ਸੀ ਪਰ ਅੱਜ ਦੇ ਜ਼ਮਾਨੇ ਵਿੱਚ ਰਿਸ਼ਤੇਦਾਰ ਬੱਚੇ ਸਾਰੇ ਚਿੜਚਿੜੇ ਹੋ ਗਏ ਹਨ ਉਹਨਾਂ ਦਾ ਗੁੱਸਾ ਹੋਰ ਵੱਧ ਗਿਆ ਹੈ ਉਹਨਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਉਹ ਕਿੱਥੇ ਜਾ ਰਹੇ ਹਨ ਸਕਰੀਨ ਦੇ ਵਧਣ ਨਾਲ ਉਨਾਂ ਨੂੰ ਐਹ ਸਭ ਨਹੀਂ ਦਿਖ ਰਿਹਾ ਉਹਨਾਂ ਦੀ ਸੋਚਣ ਦੀ ਸ਼ਮਤਾ ਵੀ ਘੱਟ ਗਈ ਹੈ ਹੁਣ ਉਹ ਸਾਰਾ ਦਿਨ ਸਕਰੀਨ ਦੇ ਆਲੇ ਦੁਆਲੇ ਘੁੰਮਦੇ ਹਨ

ਸਕਰੀਨ ਟਾਈਮ ਦੇ ਵੱਧਣ ਨਾਲ ਰਿਸ਼ਤਿਆਂ ਵਿੱਚ ਵੀ ਫਿੱਕ ਪੈ ਰਹੀ ਹੈ ਪਹਿਲਾਂ ਰਿਸ਼ਤੇਦਾਰ ਇੱਕ ਦੂਜੇ ਘਰ ਆਉਂਦੇ ਜਾਂਦੇ ਸਨ ਗੱਲਾਂ ਬਾਤਾਂ ਕਰਦੇ ਸਨ ਪਰ ਅੱਜ ਕੱਲ੍ਹ ਸਾਰੇ ਆਪਣੇ ਆਪਣੇ ਸਕਰੀਨਾਂ 'ਤੇ ਲੱਗੇ ਰਹਿੰਦੇ ਹਨ ਅਤੇ ਉਹਨਾਂ ਨੂੰ ਇੱਕ ਦੂਜੇ ਦੀ ਕੋਈ ਪਰਵਾਹ ਨਹੀਂ ਹੁੰਦੀ